ਸ਼ੂਗਰ ਦੇ ਘਰੇਲੂ ਉਪਚਾਰ ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਸਾਨੂੰ ਅੰਦਰੋਂ ਹੀ ਅੰਦਰ ਕਮਜੋਰ ਕਰਦੀ ਹੈ ਇਸ ਬਿਮਾਰੀ ਦੀ ਰੋਕਥਾਮ ਲਈ ਅਸੀਂ ਦਵਾਈਆਂ ਦਾ ਉਪਯੋਗ ਕਰਦੇ ਹਾਂ ਘਰ ਵਿੱਚ ਵੀ ਅਸੀਂ ਕਈ ਉਪਚਾਰ ਕਰਦੇ ਹਾਂ ਜਿਵੇਂ ਕਿ ਅਮਰੂਦ ਦੇ ਪੱਤਿਆਂ ਦਾ ਖਾਲੀ ਪੇਟ ਖਾਣਾ ਨਿੰਮ ਦੇ ਪੱਤਿਆਂ ਦਾ ਚੂਰਨ ਬਣਾ ਕੇ ਜਾਂ ਫਿਰ ਉਸਦਾ ਕਾੜ੍ਹਾ ਬਣਾ ਕੇ ਲਿਆ ਜਾਂਦਾ ਹੈ ਤੂੰਬੇ ਉੱਤੇ ਨੰਗੇ ਪੈਰ ਤੁਰਿਆ ਜਾਂਦਾ ਹੈ ਮੌਸਮ ਦੇ ਅਨੁਸਾਰ ਫ਼ਲ ਖਾਧੇ ਜਾਂਦੇ ਹਨ ਜਿਵੇਂ ਜਾਮੁਣ ਅਮਰੂਦ ਸੇਬ ਆਦਿ ਜਾਮਣ ਦੀ ਗਿਟਕਾਂ ਦੀ ਪਾਊਡਰ ਬਣਾ ਕੇ ਖਾਣਾ ਇਸ ਸ਼ੂਗਰ ਦਾ ਪੌਦਾ ਵੀ ਹੁੰਦਾ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਇਨਸੋਲਿਨ ਪੈਦਾ ਕਰਦਾ ਹੈ ਉਸਨੂੰ ਵੀ ਖਾਧਾ ਜਾਂਦਾ ਹੈ ਸ਼ੂਗਰ ਦੇ ਮਰੀਜ਼ ਨੂੰ ਖੰਡ ਖਾਣ ਤੋਂ ਪ੍ਰਹੇਜ਼ ਕੀਤਾ ਜਾਂਦਾ ਹੈ ਉਹ ਖੰਡ ਦੀ ਥਾਂ ਗੁੜ ਜਾਂ ਫਿਰ ਮਿਸ਼ਰੀ ਜਾਂ ਫਿਰ ਸ਼ੱਕਰ ਦੀ ਵੀ ਵਰਤੋਂ ਕਰ ਸਕਦਾ ਹੈ ਸਬਜ਼ੀਆਂ ਵਿੱਚ ਮੇਥੀ ਕਰੇਲੇ ਮੂੰਗਰੇ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਖਾਣ ਪੀਣ ਦੇ ਨਾਲ ਦੋ ਸਾਨੂੰ ਸਵੇਰ ਦੀ ਸੈਰ ਘਾਹ ਉੱਤੇ ਜਿਵੇਂ ਲਾ ਲਓ ਨੰਗੇ ਪੈਰੀਂ ਕਰਨੀ ਹੁੰਦੀ ਹੈ ਯੋਗਾ ਵੀ ਯੋਗੇ ਦੀ ਵੀ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ